ਜਿਵੇਂ ਕਿ ਪੰਜਾਬ ਦਾ ਸੱਭਿਆਚਾਰ ਬਹੁਤ ਹੀ ਅਮੀਰ ਸੱਭਿਆਚਾਰ ਸਮਝਿਆ ਜਾਂਦਾ ਹੈ ਅਤੇ ਹੈ ਵੀ ਇਹਨਾਂ ਦੇ ਵਿੱਚ ਆਪਸੀ ਭਾਈਚਾਰਾ ਆਪਸੀ ਮਿਲਵਰਨ ਪਿਆਰ ਹੌਂਸਲਾ ਇੱਕ ਦੂਜੇ ਲਈ ਲੜਨਾ ਅਣਖ ਲਈ ਲੜਨਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਸੱਭਿਆਚਾਰ ਵਿੱਚ ਪਾਈਆਂ ਜਾਂਦੀਆਂ ਹਨ ਹੌਲੀ ਹੌਲੀ ਸਮੇਂ ਦੇ ਨਾਲ ਬੜੀ ਇਹਦੇ ਵਿੱਚ ਵਿਕਸਿਤ ਹੋਇਆ ਹੈ ਪੰਜਾਬ ਪੰਜਾਬ ਦੇ ਲੋਕ ਜਿਵੇਂ ਲਿੰਗ ਭੂਮਿਕਾ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਲੜਕੀਆਂ ਨੂੰ ਪਹਿਲਾਂ ਉਹ ਮਾਨਤਾ ਪ੍ਰਾਪਤ ਨਹੀਂ ਸੀ ਜੋ ਲੜਕਿਆਂ ਨੂੰ ਹੁੰਦੀ ਸੀ ਲੜਕੀਆਂ ਨੂੰ ਹਮੇਸ਼ਾ ਪਿੱਛੇ ਸਮਝਿਆ ਜਾਂਦਾ ਸੀ ਪਰ ਹੁਣ ਕਾਫੀ ਉੱਨਤੀ ਹੋਈ ਹੈ ਕਿ ਲੋਕੀਂ ਲੜਕੀਆਂ ਨੂੰ ਵੀ ਲੜਕੇ ਜਿੰਨਾ ਦਰਜਾ ਦੇਣ ਲੱਗ ਪਏ ਹਨ ਪਰਿਵਾਰਕ ਬਣਤਰ ਦੀ ਜੇ ਗੱਲ ਕਰਦੇ ਹਾਂ ਤਾਂ ਪਰਿਵਾਰਿਕ ਬਣਤਰ ਪਹਿਲਾਂ ਬਹੁਤ ਸਾਂਝਾ ਪਰਿਵਾਰ ਹੁੰਦਾ ਸੀ ਚਾਚੇ ਤਾਏ ਸਹੁਰਾ ਜਿਵੇਂ ਲੜਕੀ ਦਾ ਸਹੁਰਾ ਸੱਸ ਜੇਠ ਜਠਾਣੀ ਇਹ ਸਾਰੇ ਇਕੱਠੇ ਰਹਿੰਦੇ ਸੀਗੇ ਬਹੁਤ ਮਤਲਬ ਕਿ ਵੱਡਾ ਪਰਿਵਾਰ ਹੁੰਦਾ ਸੀ ਪਰ ਸਮੇਂ ਦੇ ਨਾਲ ਹੌਲੀ ਹੌਲੀ ਪਰਿਵਾਰ ਟੁੱਟਦੇ ਗਏ ਅਤੇ ਪਰਿਵਾਰ ਜਿਹੜਾ ਉਹ ਸੀਮਤ ਦਾਇਰੇ ਵਿੱਚ ਰਹਿ ਗਿਆ ਸਮਾਜਿਕ ਨਿਯਮਾਂ ਦੀ ਜੇ ਗੱਲ ਕਰੀਏ ਤਾਂ ਪਹਿਲਾਂ ਸਮਾਜਿਕ ਨਿਯਮਾਂ ਦੇ ਅਧਾਰ 'ਤੇ ਸਮਾਜ ਵੀ ਕਈਆਂ ਚੀਜ਼ਾਂ ਨੂੰ ਮਾਨਤਾ ਨਹੀਂ ਸੀ ਦਿੰਦਾ ਜਿਵੇਂ ਕਿ ਕੋਈ ਲੜਕੀ ਜਿਹੜੀ ਆਪਣੀ ਮਰਜ਼ੀ ਨਾਲ ਵਿਆਹ ਨਹੀਂ ਕਰ ਸਕਦੀ ਆਪਣੀ ਵਿੱਦਿਆ ਨਹੀਂ ਪ੍ਰਾਪਤ ਕਰ ਸਕਦੀ ਕੱਪੜੇ ਨਹੀਂ ਪਾ ਸਕਦੀ ਇਹਦੇ ਨਾਲ ਵੀ ਬਹੁਤ ਜ਼ਿਆਦਾ ਜਿਹੜਾ ਵਾ ਉਹ ਵਿਕਾਸ ਹੋਇਆ ਪਹਿਲਾਂ ਨਾਲੋਂ ਅਤੇ ਸੱਭਿਆਚਾਰ ਦੇ ਵਿੱਚ ਵੀ ਕਾਫੀ ਕਹਿ ਸਕਦੇ ਹਾਂ ਕਿ ਆਈ ਹੈ ਡਿਵੈਲਪਮੈਂਟ ਆਈ ਹੈ ਵਿਕਾਸ ਹੋਇਆ ਹੈ ਲੋਕੀਂ ਪੁਰਾਤਨ ਸਮਿਆਂ ਨੂੰ ਪੁਰਾਤਨ ਚੀਜ਼ਾਂ ਨੂੰ ਭੁੱਲ ਕੇ ਨਵੀਂ ਆਧੁਨਿਕ ਯੁੱਗ ਨਾਲ ਮੋਢੇ ਨਾਲ ਮੋਢਾ ਮਾਰ ਕੇ ਚੱਲ ਰਹੇ ਹਨ ਧੰਨਵਾਦ